ਹਾਂਜੀ ਸਰ ਮੈਂ ਤੁਹਾਡੀ ਦੁਕਾਨ 'ਤੇ ਪਰਸੋਂ ਗਈ ਮੈਂ ਥੋੜ੍ਹਾ ਸੌਦਾ ਤੁਹਾਡੀ ਦੁਕਾਨ ਤੋਂ ਲੈਣਾ ਸੀਗਾ ਮੈਨੂੰ ਟੂਥਪੇਸਟ ਜਿਹੜੇ ਸੀਗੇ ਉਹ ਚਾਹੀਦੇ ਸੀਗੇ ਮੈਂ ਤੁਹਾਨੂੰ ਪੁੱਛਿਆ ਕਿ ਕਿਹੜਾ ਟੂਥਪੇਸਟ ਜਿਹੜਾ ਹੈ ਉਹ ਵਧੀਆ ਹੈ ਤੁਸੀਂ ਦੱਸਿਆ ਕਿ ਆਹ ਵਾਲਾ ਜਿਹੜਾ ਟੂਥਪੇਸਟ ਹੈ ਤੁਸੀਂ ਉਹਨੂੰ ਵਰਤੋ ਔਰ ਤੁਸੀਂ ਇਹ ਵੀ ਕਿਹਾ ਕਿ ਇਹਦਾ ਰੇਟ ਵੀ ਬਹੁਤ ਘੱਟ ਹੈ ਅਤੇ ਇਹਦਾ ਜਿਹੜਾ ਰਿਜਲਟ ਹੈ ਉਹ ਵੀ ਬਹੁਤ ਵਧੀਆ ਹੈ ਤੁਹਾਡੀ ਤਸੱਲੀ ਦੇ ਕਾਰਨ ਜਿੱਥੇ ਮੈਂ ਇੱਕ ਟੂਥਪੇਸਟ ਲੈਣਾ ਸੀ ਮੈਂ ਪੰਜ ਟੂਥਪੇਸਟ ਤੁਹਾਡੇ ਕੋ ਇਕੱਠੇ ਜਿਹੜੇ ਲੈ ਲਏ ਔਰ ਉਹਨਾਂ ਦੇ ਪੈਸੇ ਵੀ ਉਦੋਂ ਹੀ ਤੁਹਾਨੂੰ ਦੇ ਦਿੱਤੇ ਤੁਹਾਡੀ ਤਸੱਲੀ ਦੇ ਕਾਰਨ ਹੀ ਘਰ ਆ ਕੇ ਜਦੋਂ ਸਵੇਰ ਹੋਈ ਮੇਰੇ ਬੱਚਿਆਂ ਨੇ ਅਤੇ ਅਸੀਂ ਸਾਰਿਆਂ ਨੇ ਬਰੱਸ਼ ਕੀਤਾ ਜਦੋਂ ਉਸ ਟੂਥਪੇਸਟ ਨੂੰ ਵਰਤਿਆ ਤਾਂ ਮੇਰੇ ਬੱਚਿਆਂ ਦੇ ਮੂੰਹ ਦੇ ਵਿੱਚ ਤਾਂ ਛਾਲੇ ਹੋ ਗਏ ਸਰ ਮੇਰੇ ਖੁਦ ਦੇ ਜਿਹੜੇ ਦੰਦ ਨੇ ਉਸ ਟੁੱਥਪੇਸਟ ਨੂੰ ਵਰਤ ਕੇ ਕਾਲੇ ਰੰਗ ਦੇ ਕਾਲੇ ਕਾਲੇ ਵਿੱਚ ਜਿਹੜੇ ਧੱਬੇ ਨੇ ਉਹਨਾਂ ਦੇ ਬਣ ਗਏ ਨਿਹਾਇਤ ਹੀ ਨਖਿੱਧ ਕਿਸਮ ਦਾ ਤੁਹਾਡਾ ਜਿਹੜਾ ਇਹ ਪ੍ਰੋਡਕਟ ਟੂਥਪੇਸਟ ਜਿਹੜਾ ਉਹ ਸੀਗਾ ਕਹਿੰਦੇ ਹੁੰਦੇ ਨਾ ਸਸਤਾ ਰੋਵੇ ਵਾਰ ਵਾਰ ਅਤੇ ਮਹਿੰਗਾ ਰੋਵੇ ਇੱਕੋ ਵਾਰ ਮੈਨੂੰ ਤੁਹਾਡੀ ਦੁਕਾਨ ਤੋਂ ਇਹ ਚੀਜ਼ ਲੈ ਕੇ ਸਮਝ ਆ ਗਈ ਕਿ ਪੈਸੇ ਭਾਵੇਂ ਚਾਰ ਵੱਧ ਖਰਚ ਲਓ ਪਰ ਤੁਹਾਡੀਆਂ ਦਿੱਤੀਆਂ ਤਸੱਲੀਆਂ 'ਤੇ ਕਦੀ ਭਰੋਸਾ ਨਾ ਕਰੋ ਮੈਨੂੰ ਤੁਹਾਡੇ 'ਤੇ ਇਸ ਗੱਲ ਦਾ ਬਹੁਤ ਜ਼ਿਆਦਾ ਜਿਹੜਾ ਗੁੱਸਾ ਹੈ ਕਿ ਤੁਸੀਂ ਜਿਹੜੇ ਤੁਹਾਡੇ ਲਗਾਤਾਰ ਤੁਹਾਡੇ ਕੋਲ ਆਉਣ ਵਾਲੇ ਜਿਹੜੇ ਗਾਹਕ ਨੇ ਉਹਨਾਂ ਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਠੱਗੀ ਉਹ ਮਾਰਦੇ ਕੀ ਇਹ ਗੱਲ ਤੁਹਾਨੂੰ ਸ਼ੋਭਾ ਦਿੰਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਮੈਂ ਖੁਦ ਅਤੇ ਜਾਂ ਕਿਸੇ ਹੋਰ ਨੂੰ ਇਹ ਗੱਲ ਕਹਾਂਗੀ ਕਿ ਉਹ ਦੁਬਾਰਾ ਤੁਹਾਡੀ ਦੁਕਾਨ ਦੇ ਉੱਪਰ ਜਾਣ ਅਤੇ ਤੁਹਾਡੇ ਕੋਲ ਜਿਹੜਾ ਸਮਾਨ ਉਹ ਖਰੀਦਣ ਇਸ ਟੂਥਪੇਸਟਾਂ ਕਰਕੇ ਮੈਨੂੰ ਆਪਣੇ ਬੱਚਿਆਂ ਨੂੰ ਡਾਕਟਰ ਕੋਲੋਂ ਖੜਨਾ ਪਿਆ ਮੈਂ ਖੁਦ ਡੋਕਟਰ ਕੋਲ ਗਈ ਮੇਰੇ ਘਰ ਵਾਲੇ ਨੂੰ ਵੀ ਮੈਂ ਡੋਕਟਰ ਕੋਲ ਲੈ ਕੇ ਗਈ ਕਈ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ ਨੇ ਡੋਕਟਰ ਨੇ ਸਾਨੂੰ ਲਿਖ ਦਿੱਤੀਆਂ ਉਸ ਟੂਥਪੇਸਟ ਦੇ ਚੱਕਰ ਦੇ ਵਿੱਚ ਸਾਡਾ ਤਾਂ ਖੁਦ ਦਾ ਕੀੜਾ ਕਬਾੜਾ ਹੋ ਗਿਆ ਜਿਹੜੇ ਸਿਹਤ ਨੂੰ ਅਸੀਂ ਰੋਗ ਲਾਇਆ ਉਹ ਵੱਖਰਾ ਲਾਇਆ ਮੈਂ ਤੁਹਾਨੂੰ ਇਹ ਸਿੱਧੇ ਸ਼ਬਦਾਂ ਵਿੱਚ ਕਹਿੰਦੀ ਹਾਂ ਕਿ ਅੱਜ ਤੋਂ ਬਾਅਦ ਮੈਂ ਕਦੀ ਤੁਹਾਡੀ ਦੁਕਾਨ 'ਤੇ ਕੋਈ ਵੀ ਚੀਜ਼ ਲੈਣ ਨਹੀਂ ਆਵਾਂਗੀ ਅਤੇ ਜੇ ਕਦੀ ਕੋਈ ਮੇਰੇ ਕੋਲ ਇਹ ਪੁੱਛੇਗਾ ਕਿ ਤੁਸੀਂ ਉਸ ਦੁਕਾਨ 'ਤੇ ਓ ਦਾ ਐਕਸਪੀਰੀਅੰਸ ਤੁਹਾਡਾ ਕਿਹੋ ਜਿਹਾ ਹੈ ਤਾਂ ਮੈਂ ਉਹਨਾਂ ਨੂੰ ਇਹੀ ਕਹਾਂਗੀ ਕਿ ਤੁਹਾਡੀ ਦੁਕਾਨ 'ਤੇ ਕਦੀ ਨਾ ਆਉਣ ਕਿਉਂਕਿ ਜਿਹੜੇ ਤੁਹਾਡਾ ਲਗਾਤਾਰ ਤੁਹਾਡੇ ਕੋਲ ਆਉਣ ਵਾਲਾ ਗਾਹਕ ਸੀਗਾ ਤੁਸੀਂ ਉਹਦੇ ਨਾਲ ਇਹ ਸਭ ਕਰ ਸਕਦੇ ਹੋ ਅਤੇ ਜਿਹੜਾ ਗਾਹਕ ਤੁਹਾਡੇ ਕੋਲ ਪਹਿਲੀ ਵਾਰੀ ਆਉਂਦਾ ਹੋਏਗਾ ਤੁਸੀਂ ਉਹਦੇ ਨਾਲ ਕੀ ਕਰਦੇ ਹੋਵੋਗੇ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਰੋਸ ਹੈ ਬਹੁਤ ਜ਼ਿਆਦਾ ਗੁੱਸਾ ਹੈ ਤੁਹਾਡੇ 'ਤੇ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕੀਤਾ ਮੇਰੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਮੇਰੀ ਸਿਹਤ ਨਾਲ ਖਿਲਵਾੜ ਕੀਤਾ ਅਤੇ ਪਤਾ ਨਹੀਂ ਸਮਾਜ ਦੇ ਵਿੱਚ ਤੁਸੀਂ ਕਿੰਨੇ ਜਣਿਆਂ ਨੂੰ ਇਹ ਜਿਹੜਾ ਘਟੀਆ ਟੂਥਪੇਸਟ ਦੇ ਕੇ ਤੁਸੀਂ ਉਹਨਾਂ ਦਾ ਬੁਰਾ ਹਾਲ ਕੀਤਾ ਹੋਏਗਾ